ਹਾਂਜੀ ਸਾਡੇ ਜਿਹੜੇ ਪੰਜਾਬ ਦੇ ਹਸਪਤਾਲ ਨੇ ਹੈਗੇ ਉਹਨਾਂ ਦੇ ਵਿੱਚ ਜਿਹੜੀਆਂ ਤਕਨੀਕੀ ਸਹੂਲਤਾਂ ਸਾਨੂੰ ਵਧੀਆ ਮਿਲ ਰਹੀਆਂ ਨੇ ਅਤੇ ਉਹਦੇ ਵਿੱਚ ਜਿਵੇਂ ਹੁਣ ਸਾਡੇ ਪਹਿਲਾਂ ਐਕਸਰੇ ਵਗੈਰਾ ਜਾਂ ਸ ਕੁਛ ਹੁੰਦਾ ਨਹੀਂ ਸੀਗਾ ਅਤੇ ਉਹ ਵੀ ਵਧੀਆ ਮਿਲ ਰਹੇ ਆ ਅਤੇ ਫੈਸਿਲਟੀਆਂ ਸਾਰੀਆਂ ਮਿਲ ਰਹੀਆਂ ਨੇਗੀਆਂ ਅਤੇ ਇਹਦੇ ਵਿੱਚ ਸਾਡਾ ਇਹ ਹੈਗਾ ਗਾ ਵੀ ਜਿਵੇਂ ਹੁਣ ਟੈਸਟ ਮਸ਼ੀਨਾਂ ਸੀਗੀਆਂ ਜਾਂ ਉਹ ਸੀਗੀਆਂ ਆਪਣਾ ਕੀ ਕਹਿਦੇ ਹੁੰਦੇ ਆ ਸ਼ੂਗਰ ਟੈਸਟ ਕਰਨ ਵਾਲੀਆਂ ਮਸ਼ੀਨਾਂ ਸਾਰੀਆਂ ਵੀ ਵਧੀਆ ਮਿਲੀ ਜਾਂਦੀਆਂ ਨੇ ਸਾਨੂੰ ਜਿਹੜੇ ਟੈਸਟ ਵਗੈਰਾ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਹੁੰਦਾ ਸੀਗਾ ਅਤੇ ਉਹ ਸਾਨੂੰ ਸਾਡੇ ਆਪਦੇ ਹੀ ਏਰੀਏ 'ਚ ਮਿਲ ਗਈਆਂ ਨੇ ਅਤੇ ਇਹਦੇ ਨਾਲ ਸਾਡੀ ਬਹੁਤ ਮਦਦ ਹੋਈ ਆ ਜਿਹੜੇ ਸਾਡੇ ਬਜ਼ੁਰਗ ਨੇ ਉਹ ਮਤਲਬ ਐਨੀ ਜ਼ਿਆਦਾ ਦੂਰ ਤੱਕ ਜਾ ਨਹੀਂ ਸਕਦੇ ਉਹਨਾਂ ਨੂੰ ਵੀਕਲ ਵਗੈਰਾ ਦੀ ਜ਼ਰੂਰਤ ਹੋਊਗੀ ਅਤੇ ਇਸ ਲਈ ਉਹਨਾਂ ਨੂੰ ਅਸੀਂ ਸਾਨੂੰ ਬਹੁਤ ਜ਼ਿਆਦਾ ਹੈਵੀ ਹੈਲਪ ਮਿਲੀ ਹੈਗੀ ਇਸ ਚੀਜ਼ ਦੇ ਨਾਲ ਅਤੇ ਇਸ ਕਰਕੇ ਅਸੀਂ ਹੁਣ ਜਿਹੜਾ ਹੈਗੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਜਿਹੜੀਆਂ ਸਾਨੂੰ ਹਸਪਤਾਲਾਂ ਵਿੱਚ ਮਿਲਦੀਆਂ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਹੈਗੇ ਹਾਂ ਬਾਕੀ ਜਿਹੜੇ ਡਾਕਟਰ ਵਗੈਰਾ ਨੇ ਸਾਰੇ ਬਹੁਤ ਜ਼ਿਆਦਾ ਵਧੀਆ ਨੇ ਇਹ ਸਾਡੀ ਪ੍ਰੋਪਰ ਹੈਲਪ ਵੀ ਕਰੀ ਜਾਂਦੇ ਨੇ ਅਤੇ ਜਿਹਦੇ ਨਾਲ ਸਾਨੂੰ ਸਾਡੀਆਂ ਜਿਹੜੀਆਂ ਮੈਡੀਸਨ ਦੀਆਂ ਟੈਸਟਾਂ ਦੀਆਂ ਦਵਾਈਆਂ ਦੇ ਖਰਚੇ ਆਉਣ ਜਾਣ ਦੇ ਜਿਹੜੇ ਸਾਰੇ ਖਰਚੇ ਹੈਗੇ ਆ ਉਹਨਾਂ ਦਾ ਬਹੁਤ ਜ਼ਿਆਦਾ ਸਾਨੂੰ ਉਹ ਮਿਲਿਆ ਦਿਮਾਗ ਨੂੰ ਸ਼ਾਂਤੀ ਮਿਲੀ ਆ ਇਹਦਾ ਸਾਡਾ ਜਿਹੜਾ ਖਰਚਾ ਵੀ ਬਚ ਗਿਆ ਸਾਡਾ ਆਉਣ ਜਾਣ ਦਾ ਖਰਚਾ ਵੀ ਬਚ ਗਿਆ ਬਾਕੀ ਜਿਹੜੇ ਟੈਸਟ ਵਗੈਰਾ ਹੁੰਦੇ ਸੀਗੇ ਉਹਨਾਂ ਦੇ ਵੀ ਸਾਡੀ ਬੱਚਤ ਹੋ ਗਈ ਸਾਡਾ ਖਰਚਾ ਘੱਟ ਗਿਆ ਖਰਚਾ ਦੇਖੋ ਦਵਾਈਆਂ ਦਾ ਖਰਚਾ ਹੀ ਹੁੰਦਾ ਜਿਹੜਾ ਬੰਦੇ ਨੂੰ ਮਜ਼ਬੂਰ ਕਰ ਦਿੰਦਾ ਹਰ ਇੱਕ ਜਗ੍ਹਾ ਤੋਂ ਪੈਸਾ ਵੀ ਅਰੇਂਜ ਕਰਨਾ ਔਖਾ ਹੋ ਜਾਂਦਾ ਨੇ ਇਸ ਲਈ ਸਾਨੂੰ ਅਸੀਂ ਜਿਹੜੀ ਤਕਨੀਕ ਜਿਹੜੇ ਹੈਗੇ ਸਾਨੂੰ ਮਿਲੀਆਂ ਸਹੂਲਤਾਂ ਤੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਅਤੇ ਅਸੀਂ ਆਪਦਾ ਪੂਰਾ ਲਾਭ ਲੈ ਰਹੇ ਹਾਂ